ਮੇਰਾ ਸਾਰਾ ਘਰ ਸੀਮੈਂਟ ਦਾ ਹੀ ਬਣਿਆ ਹੋਇਆ ਹੈ ਭਾਵ ਕਿ ਪੱਕਾ ਘਰ ਹੈ ਸਫ਼ਾਈ ਦੇ ਪੱਖ ਤੋਂ ਜੇਕਰ ਆਪਾਂ ਦੇਖਦੇ ਹਾਂ ਤਾਂ ਮੈਂ ਆਪਣੇ ਘਰ ਦੇ ਵਿੱਚ ਕੋਈ ਵੀ ਜਗ੍ਹਾ ਕੱਚੀ ਨਹੀਂ ਛੱਡੀ ਜਿਹਦੇ ਵਿੱਚ ਮੈਂ ਕੋਈ ਬਾਗਬਾਨੀ ਜਾਂ ਫਿਰ ਕੁਛ ਹੋਰ ਇੱਦਾਂ ਦੇ ਸ਼ੌਂਕ ਜਿਹੜੇ ਮੈਂ ਪੂਰੇ ਕਰ ਲਵਾਂ ਫਿਰ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ਼ ਮੈਂ ਆਪਣੇ ਸ਼ੌਂਕ ਨੂੰ ਮਰਨ ਨਹੀਂ ਦਿੱਤਾ ਉਹਨੂੰ ਕਾਫ਼ੀ ਅੱਗੇ ਤੱਕ ਲੈ ਕੇ ਗਈ ਕੀ ਕੀਤਾ ਮੈਂ ਘਰ ਦੇ ਵਿੱਚ ਗਮਲੇ ਰੱਖੇ ਹਰੇਕ ਸਾਈਜ਼ ਦੇ ਗਮਲੇ ਕੋਈ ਛੋਟਾ ਕੋਈ ਵੱਡਾ ਕੋਈ ਉਸ ਤੋਂ ਵੀ ਵੱਡਾ ਫੁੱਲ ਸਾਈਜ਼ ਦਾ ਅਤੇ ਮੈਨੂੰ ਜ਼ਿਆਦਾ ਸ਼ੌਂਕ ਘਰ ਦੇ ਵਿੱਚ ਪੱਕੇ ਬੂਟਿਆਂ ਦਾ ਇਸ ਦੇ ਨਾਲ਼ ਜਿਹੜੇ ਸੀਜ਼ਨਲ ਫੁੱਲ ਨੇ ਉਹ ਵੀ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਪੱਕੇ ਬੂਟਿਆਂ ਦੇ ਲਈ ਮੈਂ ਉਹ ਵਾਲੇ ਵੱਡੇ ਗਮਲੇ ਚੁਣੇ ਜਿਹਦੇ ਵਿੱਚ ਘੱਟੋ ਘੱਟ ਇੱਕ ਬੋਰੀ ਮਿੱਟੀ ਦੀ ਸਮਾ ਸਕਦੀ ਹੋਵੇ ਮੇਰੇ ਘਰ ਵਿੱਚ ਇਸ ਵੇਲੇ ਮੱਛੀ ਪਾਮ ਅਰੀਕਾ ਪਾਮ ਫਾਂਡਸ ਪਾਮ ਚਾਈਨਾ ਪਾਮ ਇਹ ਸਾਰੇ ਲੱਗੇ ਹੋਏ ਨੇ ਔਰ ਘੱਟੋ ਘੱਟ ਦਸ ਸਾਲ ਹੋ ਗਏ ਨੇ ਇਹਨਾਂ ਬੂਟਿਆਂ ਨੂੰ ਦੇਖਦੀ ਨੂੰ ਅਤੇ ਅੱਜ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਜਦੋਂ ਉਹ ਦਰਖ਼ਤ ਵਰਗੇ ਹੀ ਦੇਖਣ ਨੂੰ ਲੱਗਦੇ ਨੇ ਹਾਂ ਕਈ ਵਾਰ ਮੈਂ ਪਾਣੀ ਪਾਉਣਾ ਭੁੱਲ ਜਾਂਦੀ ਹਾਂ ਪਰ ਫਿਰ ਵੀ ਮੈਂ ਬੱਚਿਆਂ ਵਾਂਗੂੰ ਉਹਨਾਂ ਨੂੰ ਪਾਲ਼ਿਆ ਹੋਇਆ ਉਹਨਾਂ ਦੀ ਦੇਖਭਾਲ ਕਰਦੀ ਹਾਂ ਘੱਟੋ ਘੱਟ ਮੇਰੇ ਕੋਲ ਅੱਠ ਗਮਲੇ ਇਹੋ ਜਿਹੇ ਹੈਗੇ ਨੇ ਜਿਹਦੇ ਵਿੱਚ ਮੈਂ ਕਾਫ਼ੀ ਵੱਡੇ ਬੂਟੇ ਲਗਾਏ ਹੋਏ ਨੇ ਜਦ ਕਿ ਦੇਖਿਆ ਜਾਵੇ ਉਹ ਸਾਰੇ ਬੂਟੇ ਜਿਹੜੇ ਨੇ ਉਹ ਧਰਤੀ ਵਿੱਚ ਲੱਗਣ ਵਾਲੇ ਨੇ ਪਰ ਐਕਸਪੈਰੀਮੈਂਟ ਕੀਤਾ ਕਿ ਇਹਨਾਂ ਬੂਟਿਆਂ ਨੂੰ ਮੈਂ ਗਮਲਿਆਂ 'ਚ ਲਗਾ ਸਕਾਂ ਇਸ ਦੇ ਨਾਲ਼ ਹੀ ਸੀਜ਼ਨਲ ਫੁੱਲ ਬਹੁਤ ਸੋਹਣੇ ਲੱਗਦੇ ਨੇ ਜਿਵੇਂ ਕਿ ਸਰਦੀਆਂ ਦੇ ਵਿੱਚ ਗਜੀਨੀਆ ਹੋ ਗਿਆ ਪੈਟੂਨੀਆ ਹੋ ਗਿਆ ਡੈਂਥਸ ਹੋ ਗਿਆ ਸੇਜ਼ ਹੋ ਗਿਆ ਹੋਰ ਕਿੰਨੇ ਤਰ੍ਹਾਂ ਦੇ ਸੋਹਣੇ ਸੋਹਣੇ ਗੇਂਦਾ ਹੋ ਗਿਆ ਗੇਂਦੀ ਹੋ ਗਏ ਲਾਲ ਗੇਂਦਾ ਸੰਤਰੀ ਗੇਂਦਾ ਉਹ ਸਾਰੇ ਮੈਂ ਛੋਟੇ ਗਮਲੇ ਰੱਖੇ ਹੋਏ ਨੇ ਔਰ ਜੇ ਮੈਂ ਕੁੱਲ ਗਿਣਤੀ ਕਰਾਂ ਤਾਂ ਮੇਰੇ ਕੋਲ ਘੱਟੋ ਘੱਟ ਸੌ ਗਮਲਾ ਘਰ ਦੇ ਵਿੱਚ ਹੈ ਜਿਸ ਦੇ ਵਿੱਚ ਮੈਂ ਹਰ ਤਰ੍ਹਾਂ ਦੇ ਇਹ ਸੀਜ਼ਨਲ ਜਿਹੜੇ ਨੇ ਬੂਟੇ ਲਗਾਉਂਦੀ ਹਾਂ ਜੇ ਕੁਝ ਹੋਰ ਨਹੀਂ ਲੱਗਦਾ ਤਾਂ ਗਰਮੀਆਂ ਦੇ ਵਿੱਚ ਮੈਂ ਉਹਦੇ ਵਿੱਚ ਦੁਪਹਿਰ ਖਿੜੀ ਲਗਾ ਦਿੰਦੀ ਹਾਂ ਰੰਗ ਬਿਰੰਗੀ ਕਿਉਂਕਿ ਦੁਪਹਿਰ ਖਿੜੀ ਦੀ ਆਪਣੀ ਵੱਖਰੀ ਸ਼ਾਨ ਹੈ ਬਹੁਤ ਸੋਹਣੀ ਲੱਗਦੀ ਹੈ ਲੱਗੀ ਹੋਈ ਫੇਰ ਇਸ ਤੋਂ ਇਲਾਵਾ ਜੇ ਮੈਂ ਬਾਗਵਾਨੀ ਦੀ ਗੱਲ ਕਰਾਂ ਤਾਂ ਮੇਰੇ ਨਾਲ਼ੋਂ ਜ਼ਿਆਦਾ ਸ਼ੌਂਕ ਮੇਰੇ ਹਸਬੈਂਡ ਨੂੰ ਸੀ ਕਿ ਘਰ ਦੀ ਛੱਤ ਦੇ ਉੱਪਰ ਮਿੱਟੀ ਲੁੱਕ ਪਾ ਕੇ ਉੱਥੇ ਇੱਕ ਛੋਟਾ ਜਿਹਾ ਖੇਤ ਬਣਾ ਲਿਆ ਜਾਵੇ ਜਿਹਦੇ ਵਿੱਚ ਮੌਸਮੀ ਸਬਜ਼ੀਆਂ ਨੇ ਉਹ ਲਗਾਈਆਂ ਜਾ ਸਕਣ ਅਸੀਂ ਪਹਿਲਾਂ ਐਕਸਪੈਰੀਮੈਂਟ ਕੀਤਾ ਕਰੀਬ ਅੱਜ ਤੋਂ ਛੇ ਸਾਲ ਪਹਿਲਾਂ ਬਹੁਤ ਸਕਸੈੱਸਫੁਲ ਹੋਇਆ ਸਰਦੀਆਂ ਦੇ ਵਿੱਚ ਅਸੀਂ ਉਹਦੇ ਵਿੱਚ ਮਟਰ ਲਗਾਏ ਮਟਰ ਦੇ ਨਾਲ਼ ਨਾਲ਼ ਉਸ ਟਾਈਮ ਦੇ ਵਿੱਚ ਜਿਹੜੀਆਂ ਸਬਜ਼ੀਆਂ ਸੀਗੀਆਂ ਸ਼ਿਮਲਾ ਮਟਰ ਦੇ ਨਾਲ਼ ਨਾਲ਼ ਅਸੀਂ ਉਦੋਂ ਲਗਾਈਆਂ ਮੂਲੀਆਂ ਸ਼ਲਗਮ ਮੇਥੀ ਮੇਥੇ ਪਾਲਕ ਧਨੀਆ ਉਹ ਸਾਰੀਆਂ ਸ ਗਾਜਰਾਂ ਈਵਨ ਅਸੀਂ ਗਾਜਰਾਂ ਵੀ ਲਗਾਈਆਂ ਔਰ ਹੋਈਆਂ ਵੀ ਸਬਜ਼ੀ ਬੜੀ ਸਵਾਦ ਬਣੀ ਉਹਨਾਂ ਦੀ ਸਰਦੀਆਂ ਦਾ ਇਹ ਐਕਸਪੈਰੀਮੈਂਟ ਸਾਡਾ ਇੰਨਾਂ ਸ਼ਾਨਦਾਰ ਰਿਹਾ ਕਿ ਜਿਹੜੀ ਵੀ ਸਬਜ਼ੀ ਹੁੰਦੀ ਸੀ ਮੈਂ ਆਪਣੇ ਆਂਢ ਗੁਆਂਢ ਵੰਡ ਵੀ ਦਿੰਦੀ ਸੀ ਯਾਦ ਆਇਆ ਮੈਨੂੰ ਮੈਂ ਗੋਭੀ ਵੀ ਲਗਾਈ ਸੀ ਦੋਨੋਂ ਤਰ੍ਹਾਂ ਦੀ ਗੋਭੀ ਫੁੱਲ ਗੋਭੀ ਵੀ ਪੱਤ ਗੋਭੀ ਵੀ ਕੁਛ ਟਾਈਮ ਲਈ ਸਾਨੂੰ ਲੱਗਿਆ ਕਿ ਮਾਲੀ ਰੱਖ ਲੈਣਾ ਚਾਹੀਦਾ ਰੱਖ ਵੀ ਲਿਆ ਲੇਕਿਨ ਮਾਲੀ ਨੇ ਸਾਨੂੰ ਉਹ ਰਿਜਲਟ ਨਹੀਂ ਦਿੱਤਾ ਜੋ ਅਸੀਂ ਉਹਦੇ ਤੋਂ ਆਸ ਕਰਦੇ ਸੀ ਇਸ ਲਈ ਮਾਲੀ ਨੂੰ ਛੱਡ ਕੇ ਅਸੀਂ ਆਪ ਹੀ ਮਾਲੀ ਅਤੇ ਮਾਲਣ ਬਣੇ ਔਰ ਆਪਣੇ ਖੇਤ ਦੀ ਆਪ ਹੀ ਅਸੀਂ ਦੇਖ ਰੇਖ ਸ਼ੁਰੂ ਕਰ ਦਿੱਤੀ ਮੈਨੂੰ ਥੋੜ੍ਹੀ ਜਿਹੀ ਹੈਲਥ ਹੈਜਡ ਹੋਣ ਕਰਕੇ ਕਿ ਜੇਕਰ ਮੈਂ ਪੈਰਾਂ ਭਾਰ ਬੈਠਦੀ ਹਾਂ ਮੈਨੂੰ ਚੱਕਰ ਆਉਣ ਲੱਗਦੇ ਨੇ ਇਹ ਡਿਊਟੀ ਮੇਰੇ ਹਸਬੈਂਡ ਨੇ ਲਈ ਕਿ ਉਹ ਖੇਤ ਦੀ ਗੋਡੀ ਕਿਵੇਂ ਕਰਨੀ ਹੈ ਰੋਜ਼ ਟਾਈਮ ਕੱਢ ਕੇ ਉਹ ਖੇਤ ਦੀ ਗੋਡੀ ਕਰਦੇ ਸੀ ਉਹਦੇ ਵਿੱਚ ਜਿੰਨਾ ਨਦੀਨ ਹੁੰਦਾ ਸੀ ਉਹ ਸਾਰਾ ਬਾਹਰ ਕੱਢ ਦਿੰਦੇ ਸੀ ਬੜਾ ਇੰਜੋਏ ਕੀਤਾ ਫਿਰ ਆਈ ਗਰਮੀਆਂ ਉਸ ਤੋਂ ਬਾਅਦ ਗਰਮੀਆਂ ਨੇ ਸਾਨੂੰ ਥੋੜ੍ਹਾ ਨਿਰਾਸ਼ ਕੀਤਾ ਕਿਉਂਕਿ ਸਾਡੀ ਜੋ ਛੱਤ ਹੈ ਉਹ ਸਾਰੇ ਪਾਸਿਓਂ ਘਿਰੀ ਹੋਈ ਹੈ ਅਤੇ ਉੱਥੇ ਗਰਮੀ ਬਹੁਤ ਪੈਂਦੀ ਹੈ ਉਸ ਟਾਈਮ ਵੀ ਅਸੀਂ ਉੱਥੇ ਲੋਬੀਆ ਕੱਦੂ ਕਰੇਲੇ ਸ਼ਿਮਲਾ ਮਿਰਚ ਹਰੀਆਂ ਮਿਰਚਾਂ ਲਾਲ ਮਿਰਚਾਂ ਇਹ ਸਾ ਤੋਰੀਆਂ ਇਹ ਸਾਰਾ ਕੁਛ ਲਗਾਇਆ ਔਰ ਇਹਦੇ ਵਿੱਚ ਸਭ ਤੋਂ ਵੱਧ ਜੋ ਸਾਨੂੰ ਫ਼ਸਲ ਮਿਲੀ ਉਹ ਸੀ ਤੋਰੀਆਂ ਅਤੇ ਹਰੀਆਂ ਮਿਰਚਾਂ ਤੋਂ ਤੋਰੀਆਂ ਮੇਰੇ ਘਰ 'ਚ ਕੋਈ ਨਹੀਂ ਸੀ ਖਾਂਦਾ ਮੈਨੂੰ ਛੱਡ ਕੇ ਇਸ ਲਈ ਮੇਰੀ ਉਹ ਮਿਹਨਤ ਬੇਕਾਰ ਗਈ ਲੇਕਿਨ ਹਰੀਆਂ ਮਿਰਚ ਇੰਨੀਆਂ ਸੋਹਣੀਆਂ ਹੋਈਆਂ ਕਿ ਮੈਂ ਚਟਨੀ ਵੀ ਬਹੁਤ ਜ਼ਿਆਦਾ ਬਣਾਈ ਔਰ ਅਚਾਰ ਵੀ ਬੜਾ ਪਾਇਆ ਲੋਬੀਆ ਦੀਆਂ ਫਲੀਆਂ ਜਿਹੜੀਆਂ ਸੀ ਉਹ ਵੀ ਅਸੀਂ ਜਦੋਂ ਤੋੜਨ ਲੱਗਦੇ ਸੀ ਅਤੇ ਇੱਕ ਟਾਈਮ ਦੇ ਵਿੱਚ ਉਹ ਕਿੱਲੋ ਕਿੱਲੋ ਟੁੱਟਦੀਆਂ ਸੀ ਉਹ ਵੀ ਮੈਂ ਬਹੁਤ ਵੰਡੀਆਂ ਸਾਰਿਆਂ ਨੂੰ ਕੁੱਲ ਮਿਲਾ ਕੇ ਘਰ ਦੇ ਵਿੱਚ ਜਦੋਂ ਮੈਂ ਰਚਨਾਤਮਕ ਢੰਗ ਦੇ ਨਾਲ਼ ਬਾਗਬਾਨੀ ਦਾ ਕੰਮ ਸ਼ੁਰੂ ਕੀਤਾ ਤਾਂ ਮਨ ਨੂੰ ਇੱਕ ਅਜੀਬ ਜਿਹਾ ਸੰਤੋਖ ਮਿਲਿਆ ਕਈ ਵਾਰ ਜਦੋਂ ਅਸੀਂ ਉਹ ਛੱਤ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਂਦੇ ਸੀ ਤਾਂ ਗਰਮੀਆਂ ਵਿੱਚ ਸਵੇਰੇ ਸਵੇਰੇ ਅਸੀਂ ਉੱਥੇ ਯੋਗਾ ਕਰਨ ਲਈ ਵੀ ਦੋਵੇਂ ਹਸਬੈਂਡ ਵਾਈਫ਼ ਬੈਠ ਜਾਂਦੇ ਸੀ ਬੜਾ ਹੀ ਸਾਡੇ ਲਈ ਉਹ ਇੱਕ ਕਮੈਂਡੇਬਲ ਮੋਮੈਂਟ ਹੁੰਦੀ ਸੀ ਅੱਛਾ ਲੱਗਦਾ ਸੀ ਟਾਈਮ ਪਾਸ ਹੁੰਦੇ ਦਾ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਸਵੇਰੇ ਵੇਲੇ ਸਾਡੇ ਦੋ ਦੋ ਤਿੰਨ ਤਿੰਨ ਘੰਟੇ ਕਿਸ ਤਰ੍ਹਾਂ ਪਾਸ ਹੋ ਜਾਂਦੇ ਸੀ ਹੁਣ ਹਸਬੈਂਡ ਨੂੰ ਵੀ ਥੋੜ੍ਹੇ ਜਿਹੇ ਹੈਲਥ ਹੈਜਡ ਆ ਰਹੇ ਨੇ ਉਹਨਾਂ ਤੋਂ ਵੀ ਲਗਾਤਾਰ ਬੈਠਿਆ ਨਹੀਂ ਜਾ ਰਿਹਾ ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹ ਆਪਣਾ ਜਿਹੜੀ ਰਚਨਾਤਮਕਤਾ ਹੈ ਇਹ ਇਸ ਤਰ੍ਹਾਂ ਹੀ ਬਣਾ ਕੇ ਰੱਖੀਏ ਅਤੇ ਸਾਡੀ ਬਾਗਵਾਨੀ ਇਸ ਤਰ੍ਹਾਂ ਹੀ ਮਹਿਕਦੀ ਰਹੇ